ਪੰਜਾਬ ਦੇ ਸੱਭਿਆਚਾਰ 'ਚ ਇੰਝ ਤਾਂ ਬਹੁਤ ਹੀ ਮੁੱਖ ਤੱਤ ਹਨ ਜਿਨ੍ਹਾਂ 'ਤੇ ਮੈਨੂੰ ਕੀ ਸਾਰੇ ਪੰਜਾਬੀਆਂ ਨੂੰ ਮਾਣ ਹੈ ਪਰ ਮੈਨੂੰ ਸਭ ਤੋਂ ਵੱਧ ਮਾਣ ਇਸ ਗੱਲ 'ਤੇ ਹੁੰਦਾ ਹੈ ਕਿ ਸਾਡੇ ਦਸਵੇਂ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਾਰ ਪੁੱਤਰ ਉਹਨਾਂ ਦਾ ਬਾਪ ਉਹਨਾਂ ਦੀ ਮਾਂ ਉਹਨਾਂ ਨੇ ਚਾਰੋਂ ਪੁੱਤਰ ਦੇ ਕੌਮ ਤੋਂ ਵਾਰਤੇ ਪੰਜਵਾਂ ਬਾਪ ਵਾਰਤਾ ਛੇਵੀਂ ਮਾਂ ਵਾਰਤੀ ਤੇ ਸੱਤਵਾਂ ਆਪ ਵਾਰਤਾ ਫਿਰ ਵੀ ਉਹਨਾਂ ਨੇ ਕਦੇ ਇਸ ਗੱਲ ਦਾ ਅਹਿਸਾਨ ਨਹੀਂ ਜਤਾਇਆ ਕਿ ਅਸੀਂ ਤੁਹਾਡੇ ਲਈ ਇਹ ਕੀਤਾ ਹੈ ਜਾਂ ਉਹ ਕੀਤਾ ਹੈ ਸਾਡੇ ਪੰਜਾਬ ਦੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਪੰਜਾਬ ਦੀ ਧਰਤੀ 'ਤੇ ਰਹਿੰਦੇ ਹਾਂ ਉਸ ਸਿੱਖ ਕੌਮ ਦੇ ਬੱਚੇ ਹਾਂ ਜਿਹਨੇ ਆਪਣੇ ਬੱਚਿਆਂ ਨੂੰ ਕੌਮ ਕਰਕੇ ਵਾਰਤਾ ਅੱਜ ਕੱਲ੍ਹ ਤਾਂ ਕੋਈ ਲੋਕ ਆਪਣਾ ਇੱਕ ਪੁੱਤਰ ਕਿਸੇ ਲਈ ਨਾ ਵਾਰੇ ਉਹ ਸਭ ਨੂੰ ਆਪਣੇ ਭਾਈ ਭੈਣ ਹੀ ਸਮਝਦੇ ਸੀ ਪਹਿਲਾਂ ਦੇ ਜ਼ਮਾਨਿਆਂ ਦੇ ਲੋਕਾਂ ਵੇਲੇ ਵੀ ਉਹਨਾਂ ਦੀ ਸੋਚ ਦਾ ਮੱਤ ਬਹੁਤ ਵਧੀਆ ਸੀ ਇਸ ਕਰਕੇ ਮੈਨੂੰ ਇਹ ਗੱਲ ਬਹੁਤ ਮਾਣਦਾਇਕ ਲੱਗਦੀ ਹੈ ਕਿ ਮੈਂ ਇਸ ਪੰਜਾਬ ਵਿੱਚ ਰਹਿੰਦੀ ਹਾਂ ਜਿੱਥੇ ਸੂਰਮੇ ਜੰਮਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਚਾਰੋਂ ਪੁੱਤਰਾਂ ਵਰਗੇ ਸ਼ਹੀਦ ਸਾਹਿਬਜ਼ਾਦੇ ਸਾਨੂੰ ਮਿਲੇ ਸਾਡੇ ਗੁਰੂ ਬਣੇ ਅਤੇ ਮੈਨੂੰ ਉਹਨਾਂ 'ਤੇ ਬਹੁਤ ਮਾਣ ਹੈ ਕਿ ਸਾਡੇ ਗੁਰੂ ਨੇ ਕੌਮ ਕਰਕੇ ਆਪਣੇ ਚਾਰੋਂ ਪੁੱਤਰ ਵਾਰਤੇ ਅਤੇ ਜ਼ਰਾ ਵੀ ਫ਼ਿਕਰ ਨਾ ਕਰੀ ਅਤੇ ਇੱਕ ਵੀ ਅੱਖ ਹੰਝੂ ਅੱਖ 'ਚੋਂ ਨਹੀਂ ਸੀ ਚੋਇਆ